ਪੰਜਾਬ ਦੇ ਲੋਕ ਨਾਚ ਭੰਗੜੇ ਦੇ ਆਮ ਤੌਰ 'ਤੇ ਕਈ ਕਈ ਕਿਸਮਾਂ ਹਨ ਜਿਵੇਂ ਕਿ ਸੰਮੀ ਝੂਮਰ ਲੁੱਡੀ ਧਮਾਲ ਸਿਆਲਕੋਟ ਸਾਪ ਖੁੰਡੇ ਮਿਰਜ਼ਾ ਆਦਿ ਇਹ ਲੋਕ ਨਾਚ ਆਮ ਤੌਰ 'ਤੇ ਬਾਹਾਂ ਉਲਾਰ ਕੇ ਅਤੇ ਪੈਰਾਂ ਦੀਆਂ ਖ਼ਾਸ ਹਰਕਤਾਂ ਦੇ ਨਾਲ ਕੀਤਾ ਜਾਂਦਾ ਹੈ ਭੰਗੜਾ ਬੜੇ ਹੀ ਉੱਚੀ ਸੰਗੀਤ ਦੇ ਨਾਲ ਕੀਤਾ ਜਾਂਦਾ ਹੈ ਜਿਸ ਵਿੱਚ ਢੋਲ ਚਿਲਗੋਜੇ ਆਦਿ ਸੰਗੀਤਕ ਸੰਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਇਹ ਪੰਜਾਬੀਆਂ ਦੇ ਖੁੱਲ੍ਹੇ ਸੁਭਾਅ ਦੇ ਨਾਲ ਪੂਰੀ ਤਰ੍ਹਾਂ ਮੇਲ ਖਾਂਦਾ ਹੈ